ਮੈਂ ਜਗਜੀਤ ਸਿੰਘ ਕੁਛ ਸਮੇਂ ਤੋਂ ਲੰਬੇ ਸਮੇਂ ਤੋਂ ਔਰਗੈਨਿਕ ਖੇਤੀ ਕਰ ਰਿਹਾ ਹਾਂ ਇਹ ਔਰਗੈਨਿਕ ਖੇਤੀ ਨਾਲ ਅਸੀਂ ਆਪਣੇ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਾ ਸਕਦੇ ਹਾਂ ਔਰ ਜੋ ਵੀ ਜ਼ਹਿਰਾਂ ਖਾਦਾਂ ਦਵਾਈਆਂ ਆਪਾਂ ਆਪਣੇ ਖੇਤ ਵਿੱਚ ਸਪਰੇਅ ਕਰਕੇ ਜ਼ਹਿਰ ਯੁਕਤ ਭੋਜਨ ਲੋਕਾਂ ਨੂੰ ਖਵਾ ਰਹੇ ਹਾਂ ਜੋ ਕਿ ਬਹੁਤ ਹੀ ਗਲਤ ਗੱਲ ਹੈ ਇਸ ਤੋਂ ਇਲਾਵਾ ਮੈਂ ਜੋ ਕਿ ਔਰਗੈਨਿਕ ਖੇਤੀ ਕਰਦਾ ਹਾਂ ਅਤੇ ਜ਼ਹਿਰ ਮੁਕਤ ਲੋਕ ਭੋਜਨ ਲੋਕਾਂ ਤੱਕ ਪਹੁੰਚਾਉਂਦਾ ਹਾਂ ਔਰ ਕਿਸੇ ਕਿਸਮ ਦੀ ਖਾਦ ਦਵਾਈ ਜਾਂ ਨਦੀਨ ਨਾਸ਼ਕ ਆਪਣੇ ਖੇਤ ਵਿੱਚ ਸਪਰੇਅ ਨਹੀਂ ਕਰਦਾ ਔਰ ਆਪ ਵੀ ਆਪਣੇ ਪਰਿਵਾਰ ਨੂੰ ਵਧੀਆ ਭੋਜਨ ਖਵਾ ਰਿਹਾ ਹਾਂ ਅਤੇ ਆਪਣੇ ਇਲਾਕੇ ਦੇ ਲੋਕਾਂ ਵਾਸਤੇ ਵੀ ਇੱਕ ਵਧੀਆ ਉਪਰਾਲਾ ਕਰ ਰਿਹਾ ਹਾਂ ਜਿਸ ਉੱਤੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ਜਦੋਂ ਲੋਕ ਮੇਰੇ ਕੋਲ ਆਉਂਦੇ ਹਨ ਅਤੇ ਮੈਂ ਇਸ ਗੱਲ 'ਤੇ ਬਹੁਤ ਮਾਣ ਮਹਿਸੂਸ ਕਰਦਾ ਕਿ ਮੈਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾ ਰਿਹਾ ਹਾਂ ਔਰ ਵਧੀਆ ਕਿਸਮ ਦੀਆਂ ਫ਼ਲ ਅਤੇ ਸਬਜ਼ੀਆਂ ਪੈਦਾ ਕਰਕੇ ਲੋਕਾਂ ਦੀ ਸਿਹਤ ਵਾਸਤੇ ਵਧੀਆ ਉਪਰਾਲਾ ਕਰ ਰਿਹਾ ਹਾਂ